ਯੋਗਾ ਦੇ ਅਭਿਆਸ ਵਿੱਚ ਨਵੇਂ ਵਿਅਕਤੀ ਨੂੰ ਸਭ ਤੋਂ ਪਹਿਲਾਂ ਯੋਗ ਬਾਰੇ ਜਾਣੂ ਕਰਵਾਉਣਾ ਚਾਹੀਦਾ ਹੈ ਉਹਨਾਂ ਨੂੰ ਦੱਸਣਾ ਚਾਹੀਦਾ ਹੈ ਜੋ ਪ੍ਰਕਿਰਿਆ ਉਹ ਵਿਅਕਤੀ ਸ਼ੁਰੂ ਕਰ ਰਿਹਾ ਹੈ ਇਹ ਪ੍ਰਕਿਰਤੀ ਦੇ ਵਿੱਚ ਇੱਕ ਬਹੁਤ ਹੀ ਵਿਸ਼ਾਲ ਪ੍ਰਕਿਰਿਆ ਹੈ ਜਿਸ ਨਾਲ ਇਨਸਾਨ ਆਪਣੀ ਆਤਮਾ ਨੂੰ ਪਰਮਾਤਮਾ ਨਾਲ ਜੋੜ ਸਕਦਾ ਹੈ ਅਜੋਕੇ ਟਾਈਮ ਦੇ ਵਿੱਚ ਤਨਾਵ ਭਰੀ ਜ਼ਿੰਦਗੀ ਦੇ ਵਿੱਚ ਸਾਨੂੰ ਖੁਸ਼ ਰਹਿਣ ਲਈ ਇੱਕ ਸਭ ਤੋਂ ਵਧੀਆ ਪ੍ਰਕਿਰਿਆ ਯੋਗ ਹੈ ਨਵੇਂ ਵਿਅਕਤੀ ਨੂੰ ਇਹ ਦੱਸਣਾ ਸਭ ਤੋਂ ਵੱਧ ਜ਼ਰੂਰੀ ਹੈ ਕਿ ਸਭ ਤੋਂ ਪਹਿਲਾਂ ਯੋਗ ਕਰਨ ਵੇਲੇ ਉਸ ਦਾ ਮਨ ਵੀ ਅੱਕੇਗਾ ਅਤੇ ਉਸਨੂੰ ਬੈਠਣ ਦੇ ਵਿੱਚ ਵੀ ਬਹੁਤ ਪਰੇਸ਼ਾਨੀ ਆਵੇਗੀ ਬਹੁਤ ਲੋਕ ਸ਼ੁਰੂ ਕਰਦੇ ਨੇ ਅਤੇ ਯੋਗ ਨੂੰ ਸਿਰਫ ਪੰਜ ਸੱਤ ਦਿਨ ਹੀ ਕਰਕੇ ਉਸ ਤੋਂ ਬਾਅਦ ਅੱਕ ਜਾਂਦੇ ਨੇ ਇਸ ਦਾ ਸਭ ਤੋਂ ਵੱਡਾ ਕਾਰਨ ਹੈ ਉਹ ਇਸ ਤੋਂ ਜਾਣੂ ਨਹੀਂ ਹੁੰਦੇ ਯੋਗ ਦੇ ਅਭਿਆਸ ਵਿੱਚ ਨਵੇਂ ਵਿਅਕਤੀ ਨੂੰ ਇਹ ਦੱਸਣਾ ਜ਼ਰੂਰੀ ਹੈ ਕਿ ਸ਼ੁਰੂਆਤ ਦੇ ਵਿੱਚ ਉਸਦਾ ਮਨ ਭਟਕੇਗਾ ਅਤੇ ਉਸਨੂੰ ਬੈਠਣ ਦੇ ਵਿੱਚ ਬਹੁਤ ਪ੍ਰੋਬਲਮ ਆਏਗੀ ਅਤੇ ਉਸ ਨੂੰ ਆਪਣੇ ਸਰੀਰਿਕ ਅੰਗਾਂ ਨੂੰ ਮੋੜਨ ਅਤੇ ਆਸਣ ਅਭਿਆਸ ਕਰਨ ਦੇ ਵਿੱਚ ਵੀ ਪ੍ਰੋਬਲਮ ਆਏਗੀ ਅਤੇ ਉਸਨੂੰ ਥਕਾਵਟ ਅਤੇ ਜੋੜਾਂ ਦਾ ਦਰਦ ਵੀ ਹੋ ਸਕਦਾ ਹੈ ਪਰ ਜੇਕਰ ਉਹ ਯੋਗ ਅਭਿਆਸ ਤੋਂ ਜਾਣੂ ਹੈ ਤਾਂ ਪੰਜ ਦਸ ਦਿਨਾਂ ਦੇ ਵਿੱਚ ਇਹ ਜੋੜਾਂ ਦਾ ਦਰਦ ਘਟ ਜਾਵੇਗਾ ਅਤੇ ਵਿਅਕਤੀ ਇੱਕ ਵਧੀਆ ਫੀਲ ਕਰੇਗਾ ਤਾਂ ਜੋ ਉਸ ਵਿਅਕਤੀ ਨੂੰ ਦਿਮਾਗ ਦੇ ਵਿੱਚ ਇੱਕ ਯੋਗ ਬਾਰੇ ਪਤਾ ਹੋਵੇਗਾ ਕਿ ਇਹ ਸ਼ੁਰੂਆਤ ਦੇ ਵਿੱਚ ਥੋੜ੍ਹਾ ਅੱਕਦਾ ਅਤੇ ਬੰਦਾ ਥੱਕਦਾ ਹੈ ਉਸ ਤੋਂ ਬਾਅਦ ਇਹ ਇੱਕ ਬਹੁਤ ਸ਼ਾਨਦਾਰ ਪ੍ਰਕਿਰਿਆ ਹੈ ਅੱਜ ਦੇ ਟਾਈਮ ਦੇ ਵਿੱਚ ਸਾਨੂੰ ਸਭ ਤੋਂ ਵੱਧ ਲੋੜ ਹੈ ਯੋਗ ਦੀ ਤਾਂ ਜੋ ਅਸੀਂ ਦਿਮਾਗੀ ਤੌਰ 'ਤੇ ਅਤੇ ਸਰੀਰਕ ਤੌਰ 'ਤੇ ਤੰਦਰੁਸਤ ਰਹੀਏ ਯੋਗ ਨੂੰ ਕਰਨ ਵਾਲੇ ਜੋ ਸਾਧਕ ਹਨ ਉਹਨਾਂ ਨੂੰ ਇਸ ਚੀਜ਼ ਉੱਪਰ ਜਾਣੂ ਕਰਵਾਉਣ ਲਈ ਵੱਧ ਤੋਂ ਵੱਧ ਸੈਮੀਨਾਰ ਲਗਾਉਣੇ ਚਾਹੀਦੇ ਹਨ ਤਾਂ ਜੋ ਉਹਨਾਂ ਦੇ ਮਨ ਦੇ ਸਵਾਲਾਂ ਦਾ ਉੱਤਰ ਮਿਲ ਸਕੇ